ਹਾਂਜੀ ਸਰ ਗਿਆਨ ਦੇ ਢਾਬੇ ਤੋਂ ਗੱਲ ਕਰ ਰਹੇ ਹੋ ਜੀ ਸਰ ਗਿਆਨ ਦੇ ਢਾਬੇ ਤੋਂ ਬੋਲ ਰਹੇ ਹਾਂ ਜੀ ਸਰ ਤੁਹਾਡਾ ਆਰਡਰ ਮਿਲਿਆ ਸੀਗਾ ਜੀ ਮੈਂ ਹਾਂਜੀ ਹਾਂਜੀ ਹਾਂਜੀ ਅਤੇ ਉਹ ਸਰ ਅਸੀਂ ਲੈਣਾ ਨਹੀਂ ਚਾਹੁੰਦੇ ਜੀ ਅਸੀਂ ਵਾਪਸ ਕਰਨਾ ਚਾਹੁੰਦੇ ਹਾਂ ਓਕੇ ਸਰ ਬਟ ਇਹਦਾ ਕਾਰਨ ਦੱਸੋ ਜੀ ਸਰ ਕਾਰਨ ਇਹ ਹੈ ਸਰ ਕਿ ਇੱਕ ਤਾਂ ਇਹ ਬਹੁਤ ਠੰਢਾ ਹੋ ਚੁੱਕਾ ਹੈ ਜੀ ਬਹੁਤ ਦੇਰ ਨਾਲ ਮਿਲਿਆ ਦੂਸਰਾ ਇਹ ਹੁਣ ਤਾਜ਼ਾ ਨਹੀਂ ਰਿਹਾ ਅਤੇ ਤੇਲ ਯੁਕਤ ਵੀ ਬਹੁਤ ਹੈ ਹਾਂਜੀ ਹਾਂਜੀ ਇਸ ਕਰਕੇ ਅਸੀਂ ਵਾਪਸ ਕਰਨਾ ਚਾਹੁੰਦੇ ਆ ਸਰ ਠੀਕ ਹੈ ਸਰ ਠੀਕ ਹੈ ਜੀ ਓਕੇ ਸਰ ਓਕੇ